ਮੈਂ ਆਪਣਾ ਯੋਗ ਅਭਿਆਸ ਆਪਣੇ ਘਰ ਦੇ ਅੰਦਰ ਨੀਚੇ ਜ਼ਮੀਨ ਉੱਪਰ ਕਰਦੀ ਹਾਂ ਮੇਰਾ ਸਥਾਨ ਨਿਸ਼ਚਿਤ ਹੈ ਮੈਂ ਇੱਕ ਕੱਪੜੇ ਦੇ ਮੈਟ ਉੱਪਰ ਆਪਣਾ ਯੋਗ ਸ਼ੁਰੂ ਕਰਦੀ ਹਾਂ ਮੇਰੇ ਦਿਨ ਦੀ ਸ਼ੁਰੂਆਤ ਸਵੇਰੇ ਨੰਗੇ ਪੈਰ ਤੁਰਨ ਤੋਂ ਬਾਅਦ ਯੁਗ ਯੋਗ ਅਭਿਆਸ ਕਰਨਾ ਹੈ ਮੇਰੀ ਹੋਈ ਕਈ ਪ੍ਰਕਾਰ ਦੀ ਯੋਗ ਸ਼ਕਤੀ ਮੈਨੂੰ ਉਸ ਜਗ੍ਹਾ ਦਾ ਮਾਹੌਲ ਬਣਾਉਣ ਵਿੱਚ ਮਦਦ ਕਰਦੀ ਹੈ ਮੇਰੀ ਚੁਣੀ ਜਗ੍ਹਾ ਦਾ ਮਾਹੌਲ ਬਹੁਤ ਵਧੀਆ ਹੈ ਮੈਂ ਆਪਣੇ ਘਰ ਦੇ ਵਿਹੜੇ ਅੰਦਰ ਖੁੱਲ੍ਹੀ ਜਗ੍ਹਾ ਵਿੱਚ ਯੋਗ ਅਭਿਆਸ ਕਰਦੀ ਹਾਂ ਜਿੱਥੇ ਕੋਈ ਵੀ ਰੌਲਾ ਰੱਪਾ ਨਹੀਂ ਪੈਂਦਾ ਮੇਰੇ ਦਿਮਾਗ ਨੂੰ ਮੇਰੇ ਮਨ ਨੂੰ ਸ਼ਾਂਤੀ ਨਾਲ ਜੁੜਨ ਵਿਚ ਇਹ ਜਗ੍ਹਾ ਬਹੁਤ ਹੀ ਯੋਗਦਾਨ ਪਾਉਂਦੀ ਹੈ ਮੇਰੀ ਆਪਣੀ ਯੋਗਤਾ ਇਸ ਨੂੰ ਨਿਰੰਤਰ ਰੱਖਣ ਵਿੱਚ ਲੱਗਦੀ ਹੈ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਮੈਂ ਬਾਹਰ ਅੰਦਰ ਵੀ ਜਾਵਾਂ ਘਰ ਤੋਂ ਬਾਹਰ ਘੁੰਮਣ ਫਿਰਨ ਵੀ ਜਾਵਾਂ ਤਾਂ ਮੈਂ ਯੋਗ ਅਭਿਆਸ ਆਪਣਾ ਨਿਰੰਤਰ ਜਾਰੀ ਰੱਖਾਂ ਇਸ ਕਰਕੇ ਮੈਂ ਆਪਣਾ ਯੋਗਦਾਨ ਇਸ ਚੀਜ਼ ਵਿੱਚ ਸਮਝਦੀ ਹਾਂ ਕਿ ਮੈਂ ਇਸ ਯੋਗ ਨੂੰ ਹਮੇਸ਼ਾ ਨਿਰੰਤਰ ਜਾਰੀ ਰੱਖਣਾ ਹੈ ਜਿਸ ਨਾਲ ਮੇਰੀ ਸਿਹਤ ਬਹੁਤ ਵਧੀਆ ਹੋ ਜਾਵੇ ਮੈਨੂੰ ਮੇਰਾ ਸਥਾਨ ਮੇਰਾ ਯੋਗ ਕਰਨ ਦਾ ਸਥਾਨ ਬਹੁਤ ਪਿਆਰਾ ਲੱਗਦਾ ਹੈ ਜਿਹੜਾ ਕਿ ਮੈਨੂੰ ਆਪਣੇ ਵੱਲ ਖਿੱਚਦਾ ਹੈ ਮੈਂ ਰੋਜ਼ਾਨਾ ਉਸ ਧਰਤੀ ਨੂੰ ਨਮਸਕਾਰ ਵੀ ਕਰਦੀ ਹਾਂ ਯੋਗ ਕਰਨਾ ਮੇਰੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣ ਚੁੱਕਿਆ ਹੈ ਧੰਨਵਾਦ